ਮੇਰੀ ਪਸੰਦੀਦਾ ਕਿਤਾਬ ਭਾਈ ਵੀਰ ਸਿੰਘ ਜੀ ਦਾ ਜੀਵਨ ਹੈ ਜੋ ਗਿਆਨੀ ਮਹਾਂ ਸਿੰਘ ਜੀ ਨੇ ਲਿਖੀ ਹੈ ਉਹਨਾਂ ਦੀ ਕਿਤਾਬ ਦਾ ਪੂਰਾ ਨਾਮ ਹੈ ਗੁਰਮੁੱਖ ਜੀਵਨ ਭਾਈ ਵੀਰ ਸਿੰਘ ਜੀ ਪੰਜਾਬੀ ਦੇ ਬਹੁਤ ਵੱਡੇ ਲਿਖਾਰੀ ਹੋਏ ਹਨ ਅਤੇ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਪੰਜਾਬੀ ਵਿੱਚ ਕਈ ਤਰ੍ਹਾਂ ਦੇ ਨਾਵਲ ਕਹਾਣੀਆਂ ਕਵਿਤਾਵਾਂ ਆਦਿ ਲਿਖਣ ਦੀ ਬਿਰਤ ਪਾਈ ਜਿਹਨਾਂ ਤੋਂ ਬਹੁਤ ਸਾਰੇ ਲੇਖਕਾਂ ਨੇ ਸੇਧ ਲੈ ਕੇ ਪੰਜਾਬੀ ਸਾਹਿਤ ਨੂੰ ਸਮਰਿੱਧ ਕੀਤਾ ਉਸ ਵਿੱਚ ਵਾਧਾ ਕੀਤਾ ਅਤੇ ਇਹ ਕਿਤਾਬ ਮੈਨੂੰ ਵਾਰ ਵਾਰ ਪੜ੍ਹਨ ਵਾਸਤੇ ਉਕਸਾਉਂਦੀ ਹੈ ਕਿਉਂਕਿ ਇਸ ਦੇ ਨਾਲ ਉਹਨਾਂ ਦੇ ਜੀਵਨ ਤੋਂ ਬਹੁਤ ਸਾਰੀਆਂ ਪ੍ਰੇਰਨਾ ਦਾ ਇੱਕ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਅਤੇ ਇਹ ਬਹੁਤ ਜੋ ਸਾਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਇਸ ਤੋਂ ਇਲਾਵਾ ਕਈ ਚੰਗੀਆਂ ਫਿਲਮਾਂ ਵੀ ਸਾਨੂੰ ਮੈਨੂੰ ਬਹੁਤ ਪਸੰਦ ਆਉਂਦੀਆਂ ਹਨ ਜਿਹਨਾਂ ਦੇ ਵਿੱਚ ਵਾਰਸ ਸ਼ਾਹ ਦੇ ਨਾਲ ਸੰਬੰਧਿਤ ਇੱਕ ਫਿਲਮ ਸੀ ਜੋ ਗੁਰਦਾਸ ਮਾਨ ਨੇ ਬਣਾਈ ਉਹ ਫਿਲਮੀ ਵੀ ਬਹੁਤ ਚੰਗੀ ਹੈ ਔਰ ਪੰਜਾਬ ਦੇ ਪੁਰਾਣੇ ਹਾਲਾਤਾਂ ਨੂੰ ਪੇਸ਼ ਕਰਦੀ ਹੈ ਉਸ ਫਿਲਮ ਦੇ ਵਿੱਚ ਪੁਰਾਣੇ ਪੰਜਾਬ ਦੇ ਸੀਨ ਨੂੰ ਬਹੁਤ ਬਖੂਬੀ ਦਿਖਾਇਆ ਗਿਆ ਹੈ